ਮੈਂ ਕਦੇ ਵੀ ਕੈਮਰੇ ਦੀ ਵਰਤੋਂ ਨਾਲ ਰੀਲਾਂ ਤਾਂ ਨਹੀਂ ਬਣਾਈਆਂ ਪਰ ਮੈਂ ਫੋਟੋਆਂ ਬਹੁਤ ਖਿੱਚੀਆਂ ਨੇ ਪਰ ਮੈਂ ਇਸ ਦੇ ਵਿੱਚ ਇਹ ਦੱਸਣਾ ਚਾਹੁੰਦੀ ਹਾਂ ਕਿ ਫੋਟੋ ਖਿੱਚਣਾ ਅਤੇ ਰੀਲਾਂ ਬਣਾਉਣਾ ਇਹ ਦੋਨੋਂ ਹੀ ਆਪਸ ਦੇ ਵਿੱਚ ਬਹੁਤ ਫਰਕ ਹੈ ਫੋਟੋ ਖਿੱਚਣ ਦੇ ਲਈ ਤੁਹਾਡਾ ਇੱਕ ਫੋਕਸ ਹੋਣਾ ਚਾਹੀਦਾ ਅਤੇ ਜਿਹੜੇ ਖਿਚਵਾ ਰਹੇ ਆ ਉਹਨਾਂ ਦਾ ਧਿਆਨ ਸਿਰਫ ਅਤੇ ਸਿਰਫ ਕੈਮਰੇ ਦੇ ਵਿੱਚ ਹੋਣਾ ਚਾਹੀਦਾ ਹੈ ਰੀਲਾਂ ਬਣਾਉਣ ਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਬਹੁਤ ਸਾਰੇ ਐਕਸ਼ਨ ਪਲੇ ਕਰਨੇ ਪੈਂਦੇ ਹੈ ਤੁਹਾਨੂੰ ਆਪਣੇ ਕੈਮਰੇ ਦੀ ਮੂਵਮੈਂਟ ਕਰਨੀ ਪੈਂਦੀ ਹੈ ਅਤੇ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਵੀ ਲੈਣੀਆਂ ਪੈਂਦੀਆਂ ਨੇ ਇੱਕ ਰੀਲ ਨੂੰ ਸ਼ੂਟ ਕਰਨ ਦੇ ਲਈ ਅਤੇ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕੱਪੜਿਆਂ ਦਾ ਧਿਆਨ ਰੱਖਣਾ ਪੈਂਦਾ ਵੋਇਸ ਦਾ ਧਿਆਨ ਰੱਖਣਾ ਪੈਂਦਾ ਐਕਟਿੰਗ ਦਾ ਧਿਆਨ ਰੱਖਣਾ ਪੈਂਦਾ ਤੁਹਾਡੇ ਆਈ ਕੰਟੈਕਟਸ ਦਾ ਧਿਆਨ ਰੱਖਣਾ ਪੈਂਦਾ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਦਾ ਕਿ ਤੁਹਾਨੂੰ ਧਿਆਨ ਰੱਖਣਾ ਪੈਂਦਾ ਪਰ ਇੱਕ ਫੋਟੋ ਖਿਚਾਉਣ ਦੇ ਲਈ ਤੁਹਾਨੂੰ ਸਿਰਫ ਅਤੇ ਸਿਰਫ ਇੱਕ ਖੜ੍ਹਨਾ ਪੈਂਦਾ ਅਤੇ ਇੱਕ ਕੈਮਰਾ ਮੈਨ ਤੁਹਾਡੀ ਫੋਟੋ ਨੂੰ ਖਿੱਚ ਦਿੰਦਾ ਅਤੇ ਉਸ ਤੋਂ ਬਾਅਦ ਫੋਟੋ ਖਿੱਚੀ ਅਤੇ ਫੋਟੋ ਨੂੰ ਕਿ ਆਪਾਂ ਯੂਜ ਕਰ ਲੈਂਦੇ ਹਾਂ ਬਟ ਜੇ ਰੀਲ ਨੂੰ ਸ਼ੂਟ ਕਰਨਾ ਤਾਂ ਉਹਦੇ ਬਹੁਤ ਸਾਰੀ ਸ਼ੂਟਿੰਗ ਕਰਨ 'ਤੇ ਬਹੁਤ ਸਾਰਾ ਟਾਈਮ ਲੱਗਦਾ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਵੀ ਲਈਆਂ ਜਾਂਦੀਆਂ ਕਈ ਵਾਰੀ ਤਾਂ ਉਹਦੀ ਲੋਕੇਸ਼ਨ ਚੇਂਜ ਕਰਨ 'ਤੇ ਉਹਨੂੰ ਰਿਵਿਊ ਕਰਨ ਦੀ ਹੀ ਬਹੁਤ ਦਿਨ ਲੱਗ ਜਾਂਦੇ ਹੈ ਅਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਫੋਟੋ ਖਿੱਚਣਾ ਇੱਕ ਸ਼ੋਰਟ ਟਰਮ ਪ੍ਰੋਸੈਸ ਹੈ ਅਤੇ ਰੀਲਾਂ ਨੂੰ ਸ਼ੂਟ ਕਰਨ ਦਾ ਇੱਕ ਲੋਂਗ ਟਰਮ ਪ੍ਰੋਸੈਸ ਹੈ ਧੰਨਵਾਦ